ਮਾਰਸ਼ਲ ਆਰਟਸ ਜੋ ਕਿ ਜ਼ਿਆਦਾਤਰ ਯੁੱਧ ਕਲਾ ਦੀਆਂ ਕਿਸਮਾਂ ਹਨ ਦੇ ਰਾਹੀਂ ਸਰੀਰਿਕ ਤੰਦਰੁਸਤੀ ਵਿੱਚ ਸੁਧਾਰ ਆ ਸਕਦਾ ਹੈ ਇਹ ਸਰੀਰ ਨੂੰ ਲਚੀਲਾ ਬਣਾ ਸਕਦਾ ਹੈ ਸਾਥ ਹੀ ਸਰੀਰ ਦੇ ਸਥਿਰਤਾ ਅਤੇ ਸਹਿਣਸ਼ੀਲਤਾ ਵਿੱਚ ਵਾਧਾ ਕਰ ਸਕਦਾ ਹੈ ਮਾਰਸ਼ਲ ਆਰਟਸ ਦੀਆਂ ਕਸਰਤਾਂ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਮਾਸਪੇਸ਼ੀਆਂ ਦੀ ਤਾਕਤ ਵਧਦੀ ਹੈ ਮਾਨਸਿਕ ਤੰਦਰੁਸਤੀ ਲਈ ਮਾਰਸ਼ਲ ਆਰਟਸ ਦਿਓ ਮਾਤਰ ਅਤੇ ਸਵੈ ਵਿਸ਼ਵਾਸ ਨੂੰ ਬਣਾਉਣ ਵਿੱਚ ਮਦਦ ਕਰ ਸਕਦੀ ਹੈ ਇਹ ਤਕਨੀਕਾਂ ਧਿਆਨ ਅਤੇ ਸੁਰੱਖਿਆਂ ਦੀਆਂ ਯੋਗਤਾਵਾਂ ਨੂੰ ਵਧਾਉਂਦੀਆਂ ਹਨ ਜਿਸ ਨਾਲ ਤਣਾਅ ਅਤੇ ਚਿੰਤਾ ਘੱਟਦੀ ਹੈ ਮਾਰਸ਼ਲ ਆਰਟਸ ਸਿਖਾਉਣ ਵਾਲੀਆਂ ਸਧਾਰਨ ਅਤੇ ਦ੍ਰਿੜ ਨੀਤੀਵਾਨ ਸੁਭਾਵ ਨੂੰ ਵੀ ਵਿਕਸਿਤ ਕਰਦੀਆਂ ਹਨ ਮਾਰਸ਼ਲ ਆਰਟਸ ਇੱਕ ਇਹੋ ਜਿਹਾ ਖੇਤਰ ਹੈ ਜੋ ਸਿਰਫ ਲੜਾਈ ਦੇ ਕੌਸ਼ਲ ਨੂੰ ਸਿੱਖਣ ਤੋਂ ਬਹੁਤ ਵੱਧ ਹੈ ਇਹ ਸਰੀਰਿਕ ਮਾਨਸਿਕ ਅਤੇ ਆਤਮਿਕ ਵਿਕਾਸ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ ਮਾਰਸ਼ਲ ਆਰਟਸ ਦੀਆਂ ਅਨੇਕ ਕਿਸਮਾਂ ਹਨ ਜਿਵੇਂ ਕਿ ਕਰਾਟੇ ਟਾਈ ਕਮਾਡੋ ਜੂਡੋ ਅਤੇ ਹੋਰ ਜੋ ਵਿਦਿਆਰਥੀਆਂ ਨੂੰ ਵੱਖ ਵੱਖ ਤਰੀਕਿਆਂ ਨਾਲ ਤੰਦਰੁਸਤ ਅਤੇ ਮਨਹੂਰ ਬਣਾਉਂਦੀਆਂ ਹਨ ਸਰੀਰਿਕ ਤੰਦਰੁਸਤ ਤੰਦਰੁਸਤੀ ਦੇ ਮਾਹਿਰ ਕਹਿੰਦੇ ਹਨ ਕਿ ਮਾਰਸ਼ਲ ਆਰਟਸ ਬਹੁਤ ਸਾਰੇ ਲਾਭ ਦਿੰਦੇ ਹਨ ਇਹਨਾਂ ਕਸਰਤਾਂ ਨਾਲ ਸਰੀਰ ਦੀ ਤਾਕਤ ਸਥਿਰਤਾ ਲਚਕਦਾ ਅਤੇ ਸਹਿਣਸ਼ੀਲਤਾ ਵੱਧਦੀ ਹੈ ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੀਆਂ ਹਨ ਅਤੇ ਹੱਡੀਆਂ ਨੂੰ ਸਹੀ ਢੰਗ ਨਾਲ ਮਜ਼ਬੂਤ ਕਰਦੀਆਂ ਹਨ ਰੋਜ਼ਾਨਾ ਮਾਰਸ਼ਲ ਆਰਟਸ ਦੀ ਪ੍ਰੈਕਟਿਸ ਨਾਲ ਸਰੀਰ ਚੁਸਤ ਅਤੇ ਤੰਦਰੁਸਤ ਰਹਿੰਦਾ ਹੈ ਇਸ ਨਾਲ ਸਰੀਰ ਦੇ ਬਦਨ ਵਾਲੇ ਵਜਨ ਨੂੰ ਕੰਟਰੋਲ ਕਰਨਾ ਵੀ ਆਸਾਨ ਹੋ ਜਾਂਦਾ ਹੈ ਮਾਰਸ਼ਲ ਆਰਟਸ ਸਿਰਫ ਸਰੀਰਿਕ ਤੰਦਰੁਸਤੀ ਵਿੱਚ ਤੱਕ ਹੀ ਸੀਮਤ ਨਹੀਂ ਹੈ ਇਹ ਮਾਨਸਿਕ ਤੰਦਰੁਸਤੀ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ ਮਾਰਸ਼ਲ ਆਰਟਸ ਦੀਆਂ ਕਸਰਤਾਂ ਅਤੇ ਪ੍ਰੈਕਟਿਸ ਸਿਖਾਉਂਦੇ ਹਨ ਕਿ ਧਿਆਨ ਕਿਵੇਂ ਕੇਂਦਰਿਤ ਕਰਨਾ ਹੈ ਅਤੇ ਮਨ ਦੀ ਸ਼ਾਂਤੀ ਨੂੰ ਕਿਵੇਂ ਪ੍ਰਾਪਤ ਕਰਨਾ ਹੈ ਇਹ ਯੋਗਤਾਵਾਂ ਮਾਨਸਿਕ ਤਣਾਅ ਚਿੰਤਾ ਅਤੇ ਡਿਪਰੈਸ਼ਨ ਤੋਂ ਰਾਹਿਤ ਰਾਹਤ ਦਿੰਦੀਆਂ ਹਨ ਮਾਰਸ਼ਲ ਆਰਟਸ ਸਿਖਾਉਂਦੇ ਹਨ ਕਿ ਸਵੈ ਵਿਸ਼ਵਾਸ ਅਤੇ ਸਵੈ ਨਿਤਰਾਉਣ ਨੂੰ ਕਿਵੇਂ ਮਜ਼ਬੂਤ ਕਰਨਾ ਹੈ ਜਦੋਂ ਵਿਦਿਆਰਥੀ ਨਵੇਂ ਕੌਸ਼ਲ ਸਿੱਖਦੇ ਹਨ ਉਹਨਾਂ ਨੂੰ ਸਫਲਤਾ ਪੂਰਵਕ ਲਾਗੂ ਕਰਦੇ ਹਨ ਤਾਂ ਇਹ ਉਹਨਾਂ ਦੇ ਆਤਮ ਵਿਸ਼ਵਾਸ ਨੂੰ ਬਹੁਤ ਵਧਾਉਂਦਾ ਹੈ ਇਸ ਤੋਂ ਇਲਾਵਾ ਮਾਰਸ਼ਲ ਆਰਟਸ ਦੀਆਂ ਸਿੱਖਾਂ ਸਿੱਖਲਾਈਆਂ ਆਤਮ ਸੁਰੱਖਿਆ ਦੇ ਨਾਲ ਨਾਲ ਸਹਿਣਸ਼ੀਲਤਾ ਅਤੇ ਆਦਰ ਸਤਿਕਾਰ ਨੂੰ ਵੀ ਪ੍ਰਮੋਟ ਕਰਦੀਆਂ ਹਨ ਮਾਰਸ਼ਲ ਆਰਟਸ ਵਿੱਚ ਸਿਖਾਏ ਜਾਣ ਵਾਲੇ ਅਧਿਆਪਕ ਅਤੇ ਸਾਥੀ ਵਿਦਿਆਰਥੀਆਂ ਦੇ ਪ੍ਰਤੀ ਆਦਰ ਅਤੇ ਅਨੁਸ਼ਾਸਨ ਜ਼ਿੰਦਗੀ ਦੇ ਹੋਰ ਖੇਤਰਾਂ ਵਿੱਚ ਲਾਗੂ ਹੁੰਦੇ ਹਨ ਇਹ ਵਿਦਿਆਰਥੀਆਂ ਨੂੰ ਇੱਕ ਜ਼ਿੰਮੇਵਾਰ ਅਤੇ ਨੈਤਿਕ ਨਾਗਰਿਕ ਬਣਾਉਣ ਵਿੱਚ ਮਦਦ ਕਰਦੇ ਹਨ ਮਾਰਸ਼ਲ ਆਰਟਸ ਸਰੀਰ ਦੇ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦੀਆਂ ਹਨ ਨਿਯਮਿਤ ਤਰੀਕੇ ਨਾਲ ਕਸਰਤ ਕਰਨ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰਥਾ ਸਮਰਥਾ ਵਧਦੀ ਹੈ ਅਤੇ ਵਿਦਿਆਰਥੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਮਿਲਦੀ ਹੈ ਇਹ ਸਰੀਰ ਨੂੰ ਤੰਦਰੁਸਤ ਅਤੇ ਚੁਸਤ ਰੱਖਣ ਵਿੱਚ ਸਹਾਇਕ ਹੁੰਦੀਆਂ ਹਨ ਸਮਾਪਤੀ ਵਿੱਚ ਮਾਰਸ਼ਲ ਆਰਟਸ ਸਿਰਫ ਇਕ ਕਸਰਤ ਨਹੀਂ ਹੈ ਇਹ ਇੱਕ ਜੀਵਨ ਸ਼ੈਲੀ ਹੈ ਜੋ ਵਿਦਿਆਰਥੀਆਂ ਨੂੰ ਸਰੀਰਕ ਮਾਨਸਿਕ ਅਤੇ ਆਧੁਨਿਕ ਤੰਦਰੁਸਤੀ ਪ੍ਰਦਾਨ ਕਰਦੀ ਹੈ